ਜਿਵੇਂ ਕਿ ਪੰਜਾਬ ਵਿੱਚ ਤਾਂ ਜਿਵੇਂ ਗਿੱਧਾ ਅਤੇ ਭੰਗੜਾ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਜਿਵੇਂ ਭੰਗੜੇ ਵਿੱਚ ਤਾਂ ਜਿਵੇਂ ਪੱਗ ਪਾਈ ਜਾਂਦੀ ਹੈ ਧੋਤੀ ਪਾਈ ਜਾਂਦੀ ਹੈ ਨਾਲ ਕੁੜਤਾ ਪਾਇਆ ਜਾਂਦਾ ਹੈ

ਹੈ ਨਾ ਅਤੇ ਜਿਵੇਂ ਗਿੱਧੇ ਵਿੱਚ ਕੁੜੀਆਂ ਘੱਗਰੇ ਪਾਉਂਦੀਆਂ ਨੇ ਸਲਵਾਰ ਸੂਟ ਵੀ ਪਾਉਂਦੀਆਂ ਨੇ ਅਤੇ ਉਹਨਾਂ 'ਤੇ ਮੋਟਾ ਮੋਟਾ ਗੋਟਾ ਲੱਗਿਆ ਹੁੰਦਾ ਹੈ ਸਿਰ 'ਤੇ ਗੋਟੇ ਵਾਲੀ ਚੁੰਨੀ ਹੁੰਦੀ ਹੈ ਅਤੇ ਨੱਕ 'ਚ ਨੱਥ ਹੁੰਦੀ ਹੈ ਬਾਹਾਂ ਵਿੱਚ ਚੂੜੀਆਂ ਪਾਈਆਂ ਜਾਂਦੀਆਂ ਹਨ ਹੋਰ ਜਿਵੇਂ ਗੁਜਰਾਤ ਵਿੱਚ ਜਿਵੇਂ ਡਾਂਡੀਆਂ ਵਗੈਰਾ ਹੁੰਦਾ ਹੈ ਉਹਦੇ ਨਾਲ ਡਾਂਡੀਆ ਦਾ ਸੈੱਟ ਹੁੰਦਾ ਉਹਨਾਂ ਕੋਲ ਉਹਨਾਂ ਦੇ ਵੀ ਲਹਿੰਗੇ ਪਏ ਹੁੰਦੇ ਲਹਿੰਗਾ ਚੋਲੀ ਪਾਇਆ ਹੁੰਦਾ ਅਤੇ ਉਹ ਡਾਂਡੀਆ ਹੁੰਦਾ ਜਿਵੇਂ ਆਪਣੇ ਬਹੁਤ ਕਲਾਸੀਕਲ ਡਾਂਸ ਨੇ ਕੁਚੀਪੂੜੀ ਹੋ ਗਿਆ ਜਿਵੇਂ ਉੜੀਆ ਹੋ ਗਿਆ ਕੱਥਕ ਹੋ ਗਿਆ ਕੱਥਕ ਵਿੱਚ ਜਿਵੇਂ ਇੱਕ ਕੱਥਕ ਵਾਲੀ ਉਹ ਡਰੈਸ ਜਿਹੀ ਹੁੰਦੀ ਹੈ ਅਤੇ ਬਾਹਾਂ ਵਿੱਚ ਚੂੜੀਆਂ ਕੰਗਣ ਵਗੈਰਾ ਪਾਏ ਜਾਂਦੇ ਨੇ ਸਿਰ 'ਤੇ ਮਾਥ ਟਿੱਕਾ ਲਾਇਆ ਜਾਂਦਾ ਜਿਵੇਂ ਗੁਜਰਾਤ ਹੋਰ ਆਪਣੇ ਕੋਲ ਹੋ ਗਏ ਬੀਹੂ ਵਿੱਚ ਨੋਰਮਲ ਸਾੜੀ ਪਾਈ ਜਾਂਦੀ ਆ ਉਹਨਾਂ ਵਿੱਚ ਇਹ ਹੁੰਦਾ ਡੰਡਿਆਂ ਉੱਤੇ ਕੁੱਦ ਕੁੱਦ ਕੇ ਨੱਚਣਾ ਹੁੰਦਾ ਜਾਂ ਇੱਕ ਦੇ ਅੰਦਰ ਇੱਕ ਬਾਂਹ ਪਾ ਕੇ ਐਵੇਂ ਨੱਚਣਾ ਹੁੰਦਾ ਹੋਰ ਜਿਵੇਂ ਮਖੋਟਾ ਡਾਂਸ ਗੈਰਾ ਹੋ ਗਿਆ ਉਹਦੇ ਵਿੱਚ ਸਿਰ 'ਤੇ ਮਖੋਟਾ ਪਾ ਕੇ ਕੀਤਾ ਜਾਂਦਾ ਜਿਵੇਂ ਇੱਕ ਹੋਰ ਆਪਣੇ ਜਿਵੇਂ ਸਾਊਥ ਏਰੀਆ ਵੱਲ ਡਾਂਸ ਹੁੰਦੇ ਨੇ ਹੈ ਨਾ ਉਹਦੇ ਵਿੱਚ ਸਿਰ 'ਤੇ ਜਿਵੇਂ ਪਾ ਕੇ ਮਖੋਟੇ ਵੱਡੇ ਵੱਡੇ ਮਖੋਟੇ ਲਾ ਕੇ ਜਾਂ ਲੱਕ ਉੱਤੇ ਮੰਜਣੀਆਂ ਬੰਨ੍ਹ ਕੇ ਨੱਚਦੇ ਨੇ ਹੈ ਨਾ ਹੋਰ ਆਪਣੇ ਕੋਲ ਜਿਵੇਂ ਬੰਗਾਲ ਵਿੱਚ ਹੋ ਗਿਆ ਸਾਈਡ ਪੱਲੂ ਤੋਂ ਪਾ ਕੇ ਸਾ ਸਾੜੀ ਬੰਨ੍ਹ ਕੇ ਅਤੇ ਉਵੇਂ ਡਾਂਸ ਕਰਦੇ ਆਂ ਹੈ ਨਾ ਹੋਰ ਜਿਵੇਂ ਆਪਣੇ ਇੱਕ ਨੋਰਮਲ ਵੈਸਟਰਨ ਡਾਂਸ ਹੋ ਗਏ ਉਹਦੇ ਵਿੱਚ ਤਾਂ ਆਪਾਂ ਵੈਸਟਰਨ ਤਰੀਕੇ ਨਾਲ ਨੋਰਮਲ ਜਿਵੇਂ ਸ ਪਾਉਦੇ ਆ ਕੱਪੜੇ ਉਹ ਵਾਲੇ ਪਾ ਲਏ ਹੈ ਨਾ ਹੋਰ ਜਿਵੇਂ ਮਤਲਬ ਕਿ ਉਹ 'ਚ ਆਪਣੇ ਹਿਮਾਚਲ ਪ੍ਰਦੇਸ਼ ਵਿੱਚ ਵੀ ਨੋਰਮਲ ਜਿਵੇਂ ਕੁੜਤਾ ਪਾ ਕੇ ਥੱਲੇ ਉਹਦੇ ਪਜਾਮਾ ਜਿਹਾ ਪਾ ਕੇ ਅਤੇ ਉਹ ਦੋ ਗੁੱਤਾਂ ਕਰਕੇ ਸਿਰ 'ਤੇ ਕਸ਼ਮੀਰੀ ਟੋਪੀ ਪਾ ਕੇ ਹਿਮਾਚਲੀ ਟੋਪੀ ਪਾ ਕੇ ਉਵੇਂ ਨੱਚਦੇ ਹਨ ਅਤੇ ਹੋਰ ਜਿਵੇਂ ਬੰਦਿਆਂ ਦਾ ਤਾਂ ਜ਼ਿਆਦਾਤਰ ਮਤਲਬ ਨੋਰਮਲ ਧੋਤੀ ਕੁੜਤਾ ਹੀ ਰਹਿੰਦਾ ਜਾਂ ਫਿਰ ਕੁੜਤਾ ਜਾਂ ਪਜਾਮਾ ਹੁੰਦਾ ਨਾਲ ਅਤੇ ਕੁੜੀਆਂ ਦੀਆਂ ਲੇਡੀਜ਼ ਦੀ ਜ਼ਿਆਦਾਤਰ ਜਿਵੇਂ ਘੱਗਰੇ ਜ਼ਿਆਦਾ ਹੁੰਦੇ ਨੇ ਘੱਗਰਾ ਚੋਲੀ ਵਗੈਰਾ ਹੁੰਦੀਆਂ ਨੇ ਜਾਂ ਜਿਵੇਂ ਰਾਜਸਥਾਨ ਵ ਵਗੈਰਾ ਵੱਲ ਤਾਂ ਸਿਰ 'ਤੇ ਬੋਰਲਾ ਵੀ ਪਾ ਲਏ ਜਾਂਦੇ ਨੇ ਮਾਥ ਟਿੱਕਾ ਬੋਰਲਾ ਵਗੈਰਾ ਵੀ ਲਾ ਲਿਆ ਜਾਂਦਾ ਤਾਂ ਇਸ ਤਰ੍ਹਾਂ ਦੇ ਬਹੁਤ ਆਪਣੇ ਪਰੰਪਰਾਦਿਕ ਮੌਕਿਆਂ 'ਤੇ ਜਿਹੜੇ ਡਾਂਸ ਕੀਤੇ ਜਾਂਦੇ ਨੇ ਤਾਂ ਬਹੁਤ ਅਲੱਗ ਅਲੱਗ ਤਰੀਕਿਆਂ ਦੇ ਆਪਣੇ ਕੋਲ ਡਾਂਸ ਨੇ ਹੈ ਨਾ ਤਾਂ ਬੀਬੂ ਹੋ ਗਿਆ ਜਿਵੇਂ ਆਪਣੇ ਕੋਲ ਉੜੀਆ ਹੋ ਗਿਆ ਕੱਥਕ ਹੋ ਗਿਆ ਕੱਥਕ ਕਲੀ ਜਿਹੜੀ ਹੁੰਦੀ ਹੈ ਬਹੁਤ ਤਰ੍ਹਾਂ ਦੇ ਇੱਥੇ ਡਾਂਸ ਕੀਤੇ ਜਾਂਦੇ ਨੇ ਆਪਣੇ ਇੰਡੀਆ ਵਿੱਚ